ਪੇਂਡੂ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੁੰਦੀਆਂ ਰਹਿੰਦੀਆਂ ਲੜਾਈ ਝਗੜੇ ਹੋਣਾ ਇਹਨਾਂ ਦੇ ਵਿੱਚ ਆਮ ਜਿਹੀ ਗੱਲ ਹੁੰਦੀ ਹੈਗੀ ਆ ਜਿਵੇਂ ਕਈ ਵਾਰ ਤਾਂ ਇਹ ਲੜਾਈ ਝਗੜੇ ਬਹੁਤ ਜ਼ਿਆਦਾ ਵੱਧ ਜਾਂਦੇ ਆ ਜਿਵੇਂ ਕਿਸੇ ਦੇ ਨਾਲ ਵੱਟ ਦਾ ਰੌਲਾ ਹੋ ਗਿਆ ਜਾਂ ਕਿਸੇ ਨੇ ਸਾਈਡ ਨਹੀਂ ਦਿੱਤਾ ਤਾਂ ਇਸ ਤਰ੍ਹਾਂ ਕਰਕੇ ਗੱਲ ਜਿਹੜੀ ਹੈਗੀ ਐਗੀ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ ਆ ਸੋ ਗੱਲ ਜਿਹੜੀ ਹੈਗੀ ਐਗੀ ਪੁਲਿਸ ਸਟੇਸ਼ਨਾਂ ਤੱਕ ਪਹੁੰਚ ਜਾਂਦੀ ਹੈਗੀ ਹੈ ਜਾਂ ਪੁਲਿਸ ਸਟੇਸ਼ਨ ਤੱਕ ਪਹੁੰਚ ਜਾਂਦੀ ਹੈ ਤਾਂ ਉਹਨਾਂ ਨੂੰ ਜਿਹੜਾ ਹੈਗਾ ਗਾ ਵਕੀਲ ਕਰਨਾ ਪੈਂਦਾ ਹੈਗਾ ਅਦਾਲਤਾਂ ਦੇ ਚੱਕਰ ਲਗਾਉਣੇ ਪੈਂਦੇ ਹੈਗੇ ਜਿਹਦੇ ਵਿੱਚ ਉਹ ਆਪਣਾ ਹੀ ਹੈ ਜਿਹੜਾ ਨੁਕਸਾਨ ਕਰ ਬੈਠਦੇ ਹੈਗੇ ਐਗੇ ਉਹਨਾਂ ਨੂੰ ਫਿਰ ਅਦਾਲਤਾਂ ਦੇ ਵਿੱਚ ਜਾਣ ਵਾਸਤੇ ਵਕੀਲ ਦੀ ਲੋੜ ਹੁੰਦੀ ਹੈਗੀ ਆ ਜਿਹਦੇ ਵਿੱਚ ਉਹ ਫਨੈਸ਼ੀਅਲੀ ਜਿਹੜੇ ਹੈਗੇ ਐਗੇ ਇੰਨੇ ਚੰਗੇ ਨਹੀਂ ਹੁੰਦੇ ਜਿਹੜੇ ਜਿਹੜੇ ਕਿ ਉਹ ਇੱਕ ਵਕੀਲ ਆ ਜਿਹੜੀ ਉਹਨੂੰ ਹਾਇਰ ਕਰ ਸਕਣ ਅਤੇ ਉਹਦੇ ਵਿੱਚ ਉਹਨਾਂ ਨੂੰ ਵਾਰ ਵਾਰ ਅਦਾਲਤਾਂ ਦੇ ਚੱਕਰ ਕਨ ਕੱਟਣੇ ਪੈਂਦੇ ਹੈਗੇ ਐਗੇ ਅਤੇ ਉਹ ਜਿਹੜੇ ਹੈਗੇ ਐਗੇ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਹੈਗੇ ਐਗੇ ਸੋ ਪੇਂਡੂ ਲੋਕਾਂ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਹੈਗੀਆਂ ਐਗੀਆਂ ਕਿਸ ਤਰ੍ਹਾਂ ਵੀ ਉਹਨਾਂ ਨੇ ਅ ਆਪਣੇ ਲੜਾਈ ਝਗੜਿਆ ਦੇ ਵਿੱਚ ਜਾਂ ਕੋਈ ਹੋਰ ਤਰ੍ਹਾਂ ਦੀਆਂ ਜਿ ਜਿਵੇਂ ਕੁਛ ਕਾਨੂੰਨੀ ਕਾਨੂੰਨੀ ਸੇਵਾਵਾਂ ਹੋਣ ਸਰਕਾਰ ਵੱਲੋਂ ਕੁਛ ਕੁਛ ਉਹਨਾਂ ਬਾਰੇ ਕੁਛ ਦਿੱਤਾ ਗਿਆ ਹੋਵੇ ਉਹਨਾਂ ਨੂੰ ਉਹਦੇ ਬਾਰੇ ਨਾ ਸਮਝ ਲੱਗੇ ਹੋਵੇ ਤਾਂ ਵੀ ਉਹਨਾਂ ਨੂੰ ਜਿਹੜੇ ਹੈਗੇ ਐਗੇ ਆਪਣੇ ਜਿਹੜੇ ਹੈਗੇ ਵਕੀਲ ਦੀ ਜਿਹੜੀ ਹੈਗੀ ਆ ਹੈਲਪ ਲੈਣੀ ਪੈਂਦੀ ਹੈਗੀ ਆ ਜੇ ਉਹਨਾਂ ਨੂੰ ਉਹ ਜਿਹੜੇ ਹੈਗੇ ਪੈਂਡੂ ਲੋਕ ਉਹ ਜਿਹੜੇ ਹੈਗੇ ਐਗੇ ਕਾਨੂੰਨ ਜਿਹੜੇ ਹੈਗੇ ਐਗੇ ਉਹ ਸਮਝ ਨਹੀਂ ਸਕਦੇ ਉਹਨਾਂ ਨੂੰ ਨੌਲੇਜ ਦੀ ਘਾਟ ਹੁੰਦੀ ਹੈਗੀ ਆ ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਗਾ ਇਹਦਾ ਸਰਕਾਰੀ ਜਿਹੜੇ ਹੈਗੇ ਹੈਗੇ ਵਕੀਲ ਵਗੈਰਾ ਦੀ ਜਿਹੜੀ ਹੈਗੀ ਐਗੀ ਹੈਲਪ ਲੈਣੀ ਪੈਂਦੀ ਹੈ ਅਤੇ ਜਿਨ੍ਹਾਂ ਨਾਲ ਉਹਨਾਂ ਨੂੰ ਇਹਨਾਂ ਮੁਸ਼ਕਿਲਾਂ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਅਤੇ ਜਿਹੜਾ ਉਹਨਾਂ ਦੀ ਵਾਸਤੇ ਇੱਕ ਉਹਨਾਂ ਦੇ ਰਹਿਣ ਸਹਿਣ ਦੇ ਵਿੱਚ ਇੱਕ ਰੁਕਾਵਟ ਬਣ ਜਾਂਦਾ ਹੈ